ਪੰਜਾਬ ਵਿੱਚ ਕਲਾ ਦੇ ਵੱਡੇ ਕਈ ਬਾਜ਼ਾਰ ਹਨ ਕੇਂਦਰ ਹਨ ਜਿੱਥੇ ਕਲਾਕ੍ਰਿਤੀਆਂ ਨੂੰ ਅਸੀਂ ਖ਼ਰੀਦ ਵੀ ਸਕਦੇ ਹਾਂ ਅਤੇ ਵੇਚ ਵੀ ਸਕਦੇ ਹਾਂ ਅਤੇ ਆਪਣੀ ਕਲਾਕਾਰੀ ਦਿਖਾ ਵੀ ਸਕਦੇ ਹਾਂ ਜਿਵੇਂ ਅੰਮ੍ਰਿਤਸਰ ਵਿੱਚ ਹਰ ਸਾਲ ਪਾਈਟੈਕਸ ਦਾ ਮੇਲਾ ਲੱਗਦਾ ਹੈ ਲੋਕ ਦੂਰੋਂ ਦੂਰੋਂ ਆ ਕੇ ਉੱਥੇ ਆਪਣੀਆਂ ਦੁਕਾਨਾਂ ਲਗਾਉਂਦੇ ਹਨ ਔਰ ਪਾਕਿਸਤਾਨ ਤੋਂ ਵੀ ਕਾਫ਼ੀ ਚੀਜ਼ਾਂ ਵੇਚਣ 'ਚ ਆਉਂਦੀਆਂ ਹਨ ਜਿੱਥੋਂ ਲੋਕ ਉਹਨਾਂ ਦੇ ਪੰਜਾਬੀ ਪਾਕਿਸਤਾਨੀ ਸੂਟ ਲੈਂਦੇ ਹਨ ਕਾਫ਼ੀ ਚੀਜ਼ਾਂ ਲੈਂਦੇ ਹਨ ਔਰ ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਇੱਕ ਆਰਟ ਗੈਲਰੀ ਹੈ ਉੱਥੇ ਵੀ ਵੁਲਨ ਦਾ ਸ਼ਿਲਪਕਾਰੀਆਂ ਦਾ ਕਾਫ਼ੀ ਕੁਛ ਮੇਲਾ ਲੱਗਦਾ ਹੈ ਜਿੱਥੋਂ ਲੋਕ ਕਈ ਚੀਜ਼ਾਂ ਲੱਭਦੇ ਹੀ ਰਹਿ ਜਾਂਦੇ ਹਨ ਪਰ ਮੇਲਿਆਂ ਵਿੱਚ ਸਾਨੂੰ ਵੱਡੇ ਵੱਡੇ ਕੇਂਦਰਾਂ 'ਚ ਇਹ ਚੀਜ਼ਾਂ ਮਿਲ ਜਾਂਦੀਆਂ ਹਨ ਪੰਜਾਬ ਵਿੱਚ ਵੈਸੇ ਵੀ ਕਈ ਮੇਲੇ ਲੱਗਦੇ ਹੈ ਹੁਸ਼ਿਆਰਪੁਰ ਵਿੱਚ ਵੀ ਇੱਕ ਦੁਸਹਿਰੇ ਤੋਂ ਸ਼ੁਰੂ ਹੁੰਦਾ ਮੇਲਾ ਦਿਵਾਲੀ ਤੋਂ ਵੀ ਅਗਲੇ ਕਾਫ਼ੀ ਦਿਨ ਤੱਕ ਚੱਲਦਾ ਹੈ ਜਿੱਦਾਂ ਉੱਥੇ ਕਾਫ਼ੀ ਪ੍ਰਾਂਤਾਂ ਤੋਂ ਲੋਕ ਆਉਂਦੇ ਹੈ ਔਰ ਆਪਣੀਆਂ ਆਪਣੀਆਂ ਕਲਾਕ੍ਰਿਤੀਆਂ ਆਪਣੇ ਪ੍ਰਾਂਤ ਦੀਆਂ ਫੇਮਸ ਚੀਜ਼ਾਂ ਉੱਥੇ ਲਗਾਉਂਦੇ ਹੈ ਜੋ ਲੋਕ ਉੱਥੇ ਪਸੰਦ ਵੀ ਕਰਦੇ ਹੈ ਅਤੇ ਖ਼ਰੀਦ ਦੇ ਵੀ ਹੈ ਇਸ ਕਰਕੇ ਪੰਜਾਬ ਵਿੱਚ ਕਲਾ ਦੇ ਵੱਡੇ ਬਾਜ਼ਾਰ ਕੇਂਦਰ ਹਨ ਜਿਹੜੀਆਂ ਚੀਜ਼ਾਂ ਅਸੀਂ ਬਾਜ਼ਾਰਾਂ 'ਚ ਜਾ ਕੇ ਨਹੀਂ ਖ਼ਰੀਦ ਸਕਦੇ ਕਿਉਂਕਿ ਕਈ ਚੀਜ਼ਾਂ ਸਾਨੂੰ ਨਜ਼ਰ ਅੰਦਾਜ਼ ਹੀ ਨਜ਼ਰ ਆਉਂਦੀਆਂ ਲੇਕਿਨ ਉਹ ਮੇਲਿਆਂ ਵਿੱਚ ਆਰਟ ਗੈਲਰੀਆਂ ਵਿੱਚ ਕੇਂਦਰਾਂ ਵਿੱਚ ਸਾਨੂੰ ਦੇਖਣ ਨੂੰ ਮਿਲ ਜਾਂਦੀਆਂ ਹਨ ਅਤੇ ਅਸੀਂ ਲੈ ਵੀ ਸਕਦੇ ਹਾਂ ਅੱਜ ਕੱਲ੍ਹ ਤਾਂ ਅਸੀਂ ਔਨਲਾਈਨ ਵੀ ਇੱਕ ਪਲੇਟਫਾਰਮ ਖੁੱਲ੍ਹ ਗਿਆ ਹੈ ਜਿਹੜੀ ਚੀਜ਼ ਸਾਨੂੰ ਬਾਜ਼ਾਰਾਂ 'ਚ ਨਹੀਂ ਮਿਲਦੀ ਜਾਂ ਅਸੀਂ ਲੱਭਦੇ ਹਾਂ ਸਾਨੂੰ ਨਹੀਂ ਮਿਲਦੀ ਉਹ ਸਾਨੂੰ ਔਨਲਾਈਨ ਨਜ਼ਰ ਆ ਜਾਂਦੀ ਹੈ ਅਤੇ ਅਸੀਂ ਲੈ ਲੈਂਦੇ ਹਾਂ ਇਸ ਕਰਕੇ ਪੰਜਾ ਮੇਲਿਆਂ ਦਾ ਪੰਜਾਬ ਦੇ ਵਿੱਚ ਜਾਂ ਕਲਾਕ੍ਰਿਤੀਆਂ ਗੈਲਰੀਆਂ ਦਾ ਪੰਜਾਬ ਦੇ ਵਿੱਚ ਬੜਾ ਹੀ ਇੱਕ ਖ਼ਾਸ ਸਥਾਨ ਹੈ ਜਿਹੜੀਆਂ ਚੀਜ਼ਾਂ ਅਸੀਂ ਉੱਥੋਂ ਲੈ ਸਕਦੇ ਹਾਂ ਅਤੇ ਸਾਨੂੰ ਆਪਣੀ ਪ੍ਰਾਂਤਾ ਦੀਆਂ ਵੱਖਰੀਆਂ ਵੱਖਰੀਆਂ ਚੀਜ਼ਾਂ ਵੀ ਵੇਖਣ ਨੂੰ ਮਿਲਦੀਆਂ ਹਨ